ਪੰਜਾਬ ਵਿੱਚ ਟੈਕਨੋਲੋਜੀ ਖੇਤਰ ਦੇ ਵਿਕਾਸ ਵਿੱਚ ਬਹੁਤ ਜਿਆਦਾਂ ਯੋਗਦਾਨ ਪਾਉਂਦਾ ਹੈ ਇਹ ਉਥੋਂ ਦੇ ਲੋਕਾਂ ਨੂੰ ਆਈਟੀ ਸੈਕਟਰ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਕਰਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੀ ਮਾਲੀਆ ਹਾਲਤ ਨੂੰ ਵਿੱਚ ਸੁਧਾਰ ਕਰਦਾ ਹੈ ਉਹਨਾਂ ਨੂੰ ਪ੍ਰੋਡਕਸ਼ਨ ਦੀ ਜੋ ਹੈ ਕੋਸਟ ਵਧੀਆ ਤਰੀਕੇ ਨਾਲ ਜੋ ਵੀ ਕੋਈ ਚੀਜ਼ ਬਣਦੀ ਹੈ ਉਸ ਤੇ ਵਧੀਆ ਕੋਸਟ ਵਿੱਚ ਪ੍ਰਾਪਤ ਕਰਦਾ ਹੈ ਉਹਨਾਂ ਨੂੰ ਆਪਣੇ ਹੋਰ ਬੇਲੋੜ ਜਿਹੜੀ ਕੋਈ ਚੀਜ਼ ਹੁੰਦੀ ਆ ਉਸਨੂੰ ਬਣਾਉਣ ਵਿੱਚ ਉਸਦੇ ਜਿਹੜੇ ਬੇਲੋੜੇ ਪਾਰਟਸ ਹੁੰਦੇ ਨੇ ਉਹਨਾਂ ਨੂੰ ਹਟਾ ਕੇ ਉਹਨੂੰ ਹੋਰ ਵੀ ਜਿਆਦਾ ਕੁਸ਼ਲ ਬਣਾਉਂਦਾ ਹੈ ਅਤੇ ਇਸ ਦੇ ਨਾਲ ਜੋ ਹੈ ਲੋਕਾਂ ਨੂੰ ਹੋਰ ਵਧੀਆ ਜੋਬਸ ਪ੍ਰੋਵਾਈਡ ਹੁੰਦੀਆਂ ਹਨ ਉਹਨਾਂ ਜਿਵੇਂ ਕੀ ਤੁਸੀਂ ਜਾਣਦੇ ਹੋ ਕੀ ਆਈ ਟੀ ਸੈਕਟਰ ਸਿਰਫ ਇੱਕਲਾ ਆਈ ਟੀ ਸੈਕਟਰ ਵਿੱਚ ਹੀ ਵਿਕਾਸ ਨਹੀਂ ਹੁੰਦਾ ਉਥੋਂ ਦੇ ਆਸ ਪਾਸ ਦੇ ਖੇਤਰ ਦਾ ਵੀ ਵਿਕਾਸ ਹੁੰਦਾ ਹੈ ਆਈ ਟੀ ਸੈਕਟਰ ਟੈਕਨੋਲਜੀ ਖੇਤਰ ਦੇ ਵਿੱਚ ਵਿਕਾਸ ਹੋਣ ਨਾਲ ਉਥੋਂ ਦੀ ਜੋ ਹੈ ਰਹਿਣ ਸਹਿਣ ਦੀ ਜਗ੍ਹਾ ਵਿੱਚ ਵੀ ਵਾਧਾ ਹੋਊਗਾ ਲੋਕ ਉਥੇ ਆਸੇ ਪਾਸੇ ਦੂਰੋਂ ਆ ਕੇ ਜੋ ਕੀ ਦੂਰ ਦੂਰ ਜੋਬ ਕਰਦੇ ਨੇ ਉੱਥੇ ਨੇੜੇ ਆ ਰਹਿਣਗੇ ਉੱਥੋਂ ਦੀ ਜਨਸੰਖਿਆ ਵਿੱਚ ਵਾਧਾ ਹੋਊਗਾ ਉਥੋਂ ਦੇ ਜੋ ਐ ਪ੍ਰੋਪਰਟੀ ਵਿੱਚ ਵਾਧਾ ਹੋਏਗਾ ਉਥੋਂ ਦੇ ਲੋਕ ਉੱਥੇ ਆ ਕੇ ਰਹਿਣਗੇ ਤੇ ਉਥੇ ਆਕੇ ਹੀ ਜੋਬ ਕਰਨਗੇ ਤਾਂ ਕੀ ਉਹਨਾਂ ਨੂੰ ਦੂਰੋਂ ਆਉਣਾ ਜਾਣਾ ਨਾ ਪਵੇ ਉਥੇ ਵਾਧਾ ਹੋਣ ਨਾਲੋਂ ਉਹਨਾਂ ਨੂੰ ਸਭ ਕੁਛ ਇਜੀਲੀ ਪ੍ਰੋਵਾਈਡ ਹੋ ਜਾਏਗਾ ਧੰਨਵਾਦ